ਮੈਨੂੰ ਡਾਂਸ ਦੀਆਂ ਇੱਕ ਗਿੱਧਾ ਅਤੇ ਭੰਗੜਾ ਬਹੁਤ ਪਸੰਦ ਹੈ ਕੀ ਹੈ ਮੈਂ ਛੋਟੇ ਹੁੰਦੇ ਤੋਂ ਹੀ ਗਿੱਧਾ ਅਤੇ ਭੰਗੜਾ ਮਤਲਬ ਕਰਦੀ ਆਈ ਹਾਂ ਅਤੇ ਗਿੱਧਾ ਅਤੇ ਭੰਗੜਾ ਦੇ ਵਿੱਚ ਕੀ ਹੈ ਇਹ ਕੀ ਹੈ ਐਨਰਜੀ ਵਾਲੇ ਮਤਲਬ ਡਾਂਸ ਨੇ ਜਿਹਦੇ ਵਿੱਚ ਕੀ ਹੈ ਬੰਦਾ ਪੂਰਾ ਹੁੱਬ ਜਾਂਦਾ ਖੁੱਭ ਜਾਂਦਾ ਕਿ ਮਤਲਬ ਖੋ ਕੇ ਡਾਂਸ ਕਰਦਾ ਜਿਹਦੇ ਨਾਲ ਕੀ ਹੈ ਮਤਲਬ ਕਿ ਅ ਉਹਦੀਆਂ ਜਿਹੜੀਆਂ ਸਾਰੀਆਂ ਮਤਲਬ ਕ ਸ਼ੈਲੀਆਂ ਨੇ ਮਤਲਬ ਸ਼ੈਲੀਆਂ ਇਨ ਦਾ ਸੈਨਸ ਉਹਦੇ ਸੈਨਸਿਸ ਨੇ ਉਹ ਸਾਰੇ ਕੰਮ ਕਰਦੇ ਨੇ ਅਤੇ ਕੀ ਆ ਆਪਾਂ ਮਤਲਬ ਕਿ ਪੂਰਾ ਇੰਜੋਏ ਕਰ ਕੇ ਕੀ ਆ ਜਿਹੜਾ ਮਤਲਬ ਡਾਂਸ ਨੂੰ ਡਾਂਸ ਦੀ ਤਰ੍ਹਾਂ ਪੂਰਾ ਇੰਜੋਏ ਕਰ ਕੇ ਕੀ ਹੈ ਕਰ ਸਕਦਾ ਬੰਦਾ ਅਤੇ ਉਹ ਕੀ ਹੈ ਹਰੇਕ ਮਤਲਬ ਸ਼ ਮਤਲਬ ਜਦੋਂ ਵੀ ਕੋਈ ਵੀ ਡਾਂਸ ਸਿਖਦੇ ਹਾਂ ਜਾਂ ਕਰਦੇ ਹਾਂ ਉਦੋਂ ਤੱਕ ਉਹ ਡਾਂਸ ਜਾਂ ਮਤਲਬ ਕੁਛ ਮਤਲਬ ਕੋਈ ਵੀ ਡਾਂਸ ਹੈ ਉਹ ਡਾਂਸ ਡਾਂਸ ਨਹੀਂ ਲੱਗਦਾ ਜਦੋਂ ਤੱਕ ਬੰਦਾ ਉਹਦੇ ਵਿੱਚ ਖੁੱਭ ਕੇ ਨਾ ਕਰੇ ਅਤੇ ਉਹ ਅੰਦਰੋਂ ਨਿਕਲ ਕੇ ਨਾ ਆਵੇ ਭੰਗੜਾ ਅਤੇ ਗਿੱਧਾ ਇਹੋ ਜਿਹਾ ਕਿ ਅਗਲਾ ਅ ਕਰਨ ਲੱਗ ਜੇ ਸਿੱਖਣ ਲੱਗ ਜੇ ਅਤੇ ਉਹਨੂੰ ਥੋੜ੍ਹਾ ਬਹੁਤ ਵੀ ਆਉਣ ਲੱਗ ਜੇ ਤਾਂ ਬੰਦਾ ਕਿ ਉੱਭਰ ਕੇ ਉਹ ਚੀਜ਼ ਹੈ ਜਿਹੜੀ ਉਹ ਬਾਹਰ ਆਉਂਦੀ ਹੈ ਤਾਂ ਬੰਦਾ ਕੀ ਹੈ ਦਿਖਦਾ ਵੀ ਹਾਂ ਠੀਕ ਆ ਕਰ ਰਿਹਾ ਡਾਂਸ ਇਸ ਲਈ ਮੈਨੂੰ ਇਹ ਦੋਨੋਂ ਗਿੱਧਾ ਅਤੇ ਭੰਗੜਾ ਬਹੁਤ ਜ਼ਿਆਦਾ ਪਸੰਦ ਹੈ ਕਿਉਂਕਿ ਇੱਕ ਤਾਂ ਇਹਦੇ ਵਿੱਚੋਂ ਕੀ ਹੈ ਟੀਮ ਵਰਕ ਬਹੁਤ ਵਧੀਆ ਮਤਲਬ ਢੰਗ ਨਾਲ ਅਗਰ ਆਪਾਂ ਇੱਕ ਟੀਮ ਕਰਦੀ ਆ ਤਾਂ ਸਾਰਿਆਂ ਦਾ ਮਤਲਬ ਜਦੋਂ ਕਰਦੇ ਆ ਤਾਂ ਹਾਂ ਪਤਾ ਲੱਗਦਾ ਵੀ ਬਾਕਾਈ ਕੋਈ ਡਾਂਸ ਹੈ ਅਤੇ ਵਧੀਆ ਢੰਗ ਨਾਲ ਉੱਭਰ ਕੇ ਇਹ ਆਉਂਦਾ